ਉਸ ਟਾਈਮ ਜਦੋਂ ਮੈਂ ਉਹਨੂੰ ਅਨਬੋਕਸ ਕੀਤਾ ਤਾਂ ਉਹ ਐਨਾ ਮਤਲਬ ਕਿ ਐਨੀ ਗੰਦੀ ਪੈਕੇਜਿੰਗ ਕੀਤੀ ਹੋਈ ਸੀ ਅਤੇ ਗੱਤਾ ਐਨਾ ਬ ਸਮੈਲ ਮਾਰ ਰਿਹਾ ਸੀ ਅਤੇ ਜੋ ਉਸ ਵਿੱਚ ਮਟੀਰੀਅਲ ਮੈਂ ਡੋਮਸ ਦੀਆਂ ਪੈਂਸਿਲਸ ਮੰਗਵਾਈਆਂ ਸੀ ਉਹ ਵੀ ਐਨੀਆਂ ਘਟੀਆ ਕੁਆਲਿਟੀ ਦੀਆਂ ਪੈਂਨਸਿਲਸ ਸੀ ਜਦੋਂ ਮੈਂ ਉਹਨਾਂ ਨੂੰ ਘਟਦੀ ਸੀ ਤਾਂ ਉਹਨਾਂ ਦਾ ਸਿੱਕਾ ਟੁੱਟ ਜਾਂਦਾ ਸੀ ਅਤੇ ਨਾਲ ਦੀ ਨਾਲ ਜਦੋਂ ਮੈਂ ਉਹਨਾਂ ਨੂੰ ਕ ਕਾਗਜ਼ 'ਤੇ ਦ ਉਹਨਾਂ ਨਾਲ ਲਿਖਦੀ ਸੀ ਜਾਂ ਕਲਰ ਕਰਦੀ ਸੀ ਤਾਂ ਉਹਦਾ ਉਦੋਂ ਵੀ ਉਹਦਾ ਸ ਸਿੱਕਾ ਟੁੱਟ ਜਾਂਦਾ ਸੀ ਇਸ ਕਰਕੇ ਮੈਨੂੰ ਜੋ ਮੈਂ ਮੰਗਵਾਇਆ ਮੈਂ ਉਹਦੇ ਨਾਲ ਬਿਲਕੁਲ ਵੀ ਸੈਟਿਸਫਾਈਡ ਨਹੀਂ ਹਾਂ ਅਤੇ ਮੈਨੂੰ ਬਿਲਕੁਲ ਇਹ ਪਸੰਦ ਨਹੀਂ ਆਈ ਹੈਗੀ ਏ ਇਸ ਪ੍ਰਕਾਰ ਮੀਸੋ ਦਾ ਪ੍ਰੋਡਕਟ ਬਹੁਤ ਬੇਕਾਰ ਸੀ